ਖੇਤੀ ਵਾਰੀ ਖੇਤੀ ਲਈ ਸਾਨੂੰ ਪਹਿ ਸਭ ਤੋਂ ਪਹਿਲੀ ਇਹ ਗੱਲ ਵੀ ਸਾਨੂੰ ਖੇਤੀ ਇਹ ਆਉਣੀ ਚਾਹੀਦੀ ਹੈ ਚਾਹੇ ਆਪਾਂ ਹੁਣ ਕਰੀਏ ਚਾਹੇ ਕੱਲ੍ਹ ਨੂੰ ਕਰੀਏ ਸਾਨੂੰ ਇਸ ਬਾਰੇ ਨੌਲੇਜ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਜੇ ਬੰਦੇ ਨੂੰ ਕੋਈ ਹੋਰ ਕੰਮ ਨਾ ਹੋਵੇ ਬੰਦਾ ਖੇਤੀ ਕਰ ਸਕਦਾ ਅਤੇ ਇਹਦੇ ਬਾਰੇ ਨੌਲੇਜ਼ ਵੀ ਕਿੰਨੀ ਖਾਦ ਪੈਂਦੀ ਹੈ ਕਿੰਨੀ ਸਪਰੇਹਾਂ ਹੁੰਦੀਆਂ ਹਨ ਸਭ ਤੋਂ ਪਹਿਲੀ ਗੱਲ ਸਾਨੂੰ ਇਹ ਹੈ ਸਾਨੂੰ ਔਰਗੈਨਿਕ ਖੇਤੀ ਕਰਨੀ ਚਾਹੀਦੀ ਹੈ ਸਾਨੂੰ ਦੇਸੀ ਖਾਦ ਪਾਉਣੀ ਚਾਹੀਦੀ ਹੈ ਜਿਵੇਂ ਰੇਅ ਹੋ ਗਿਆ ਢੇਰ ਹੋ ਗਿਆ ਢੇਰ ਪਾ ਕੇ ਖੇਤੀ ਕਰ ਲਓ ਔਰਗੈਨਿਕ ਖੇਤੀ ਕਰ ਲਓ ਆਪਣੀ ਏ ਟੂ ਜੈੱਡ ਸਾਰੇ ਹੀ ਇਹ ਕਰਨਾ ਚਾਹੀਦਾ ਅਤੇ ਜਿਹੜੀ ਅੱਜ ਕੱਲ੍ਹ ਆਉਣ ਵਾਲੀ ਪੀੜ੍ਹੀ ਹੈ ਆਪਣੀ ਚੰਗੇ ਸਾਰਾ ਸਮਾਨ ਹੋਣਾ ਚਾਹੀਦੀ ਹੈ ਫਾਲੇ ਰੂਟਾਵੇਟਰ ਤਵੀਆਂ ਸੁਹਾਗਾ ਹੱ ਟਰੈਕਟਰ ਟਰੈਲੀ ਵੱਟਾਂ ਪਾਉਣੇ ਵਾਲਾ ਇਹ ਆਪਣੇ ਕੋਲ ਹੋਣਾ ਚਾਹੀਦਾ ਹੈ ਵੱਧ ਤੋਂ ਵੱਧ ਜੇ ਬੰਦਾ ਖੇਤੀ ਕਰਦਾ ਹੈ ਪੀ ਆਪਣਾ ਸਮਾਨ ਹੋਣਾ ਚਾਹੀਦਾ ਜ਼ਰੂਰੀ ਹੈ ਜੇ ਆਪਣਾ ਸਮਾਨ ਹੈ ਤਾਂ ਬੰਦਾ ਖੇਤੀ ਵਧੀਆ ਕਰਦਾ ਹੈ ਨਾ ਕਿਸੇ ਤੋਂ ਮੰਗਣ ਦੀ ਲੋੜ ਹੈ ਨਾ ਕੁਛ ਹੋਰ ਵਾਸਤਾ ਅਤੇ ਹਾਂ ਆਪਾਂ ਖੇਤੀ ਕਰ ਲੈਣ ਅਸੀਂ ਕਿਸੇ ਦੇ ਮੰਗ ਲਵਾਂਗੇ ਬੰਦਾ ਇੱਕ ਦਿਨ ਦੇ ਦੂ ਦੋ ਦਿਨ ਦੇ ਦੂ ਬੰਦਾ ਨਹੀਂ ਦਊਂਗਾ ਇਸ ਕਰਕੇ ਜਿਹੜਾ ਵੀ ਆਪਾਂ ਨਵੀਂ ਪੀੜ੍ਹੀ ਸ਼ੁਰੂ ਕਰੂਗੀ ਖੇਤੀ ਉਹਨੂੰ ਇੱਕ ਤਾਂ ਨੌਲੇਜ ਸਭ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਜਿੰਨੀ ਬੰਦੇ ਨੂੰ ਨੌਲੇਜ ਹੋਉਂਗੀ ਉੱਨਾ ਸਾਨੂੰ ਬੈਨੀਫਿਟ ਹੈ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਪੀ ਹਾਂ ਖਾਦ ਕਿੰਨੀ ਪਾਉਣੀ ਹੈ ਕਿੰਨਾ ਉਹ ਕਰਨਾ ਕਿੰਨਾ ਉਹ ਅਤੇ ਇਹਦਾ ਸਾਨੂੰ ਇਹ ਹੀ ਸਾਰਾ ਬੈਨੀਫਿਟ ਹੈ ਕਿ ਆਪਣਾ ਨੌਲੇਜ ਰੱਖੋ ਆਪਣੇ ਜਿੱਦਾਂ ਪਾਪਾ ਖੇਤੀ ਕਰਦੇ ਪਾਪਾ ਨਾਲ ਖੇਤਾਂ ਨੂੰ ਚੱਲ ਜੋ ਪਾਪਾ ਨੂੰ ਪੁੱਛੋ ਪੀ ਹਾਂ ਪਾਪਾ ਕਿੰਨੀ ਖਾਦ ਪੈਂਦੀ ਹੈ ਕਿੰਨੀ ਵਾਰ ਖੇਤ ਵਾਹੁਣੇ ਹੈ ਕਿੰਨੀ ਵਾਰ ਖੇਤ ਤਿਆਰ ਕਰਨੇ ਹੈ ਹਾਂ ਜੇ ਨਹੀਂ ਕੰਮ ਹੁੰਦਾ ਨੌਲੇਜ ਬੰਦੇ ਨੂੰ ਰੱਖਣੀ ਚਾਹੀਦੀ ਹੈ ਜੇ ਬੰਦੇ ਨੂੰ ਕੰਮ ਨਹੀਂ ਮਿਲਦਾ ਸਰਕਾਰੀ ਨੌਕਰੀ ਨਹੀਂ ਮਿਲਦੀ ਪ੍ਰਾਈਵੇਟ ਨਹੀਂ ਮਿਲਦੀ ਆਪਣੇ ਕੋਲ ਜਮੀਨ ਹੈ ਆਪਣੇ ਕੋਲ ਸਭ ਕੁਛ ਹੈ ਬੰਦਾ ਖੇਤੀ ਕਰੋ ਸਾਰਾ ਕੁਛ ਬੰਦਾ ਕਰ ਸਕਦਾ ਹੈ ਖੇਤੀ ਪੜ੍ਹੋ ਜੋ ਮਰਜ਼ੀ ਕਰੋ ਪਰ ਵੱਧ ਤੋਂ ਵੱਧ ਸਾਨੂੰ ਖੇਤੀ ਦੇ ਲਾਭ ਖੇਤੀ ਲਾਭ ਸਾਨੂੰ ਕਣਕ ਝੋਨਾ ਆਲੂ ਗੰਨਾ ਬੂਟਾ ਸਾਨੂੰ ਮਿਲਦਾ ਇਹ ਹੈ